ਮੈਂ ਪੰਜਾਬ ਦੇ ਪੇਂਡੂ ਇਲਾਕੇ ਨਾਲ ਸੰਬੰਧਿਤ ਰੱਖਣ ਵਾਲਾ ਆਦਮੀ ਆ ਪੇਂਡੂ ਇਲਾਕਾ ਉਹ ਇਲਾਕਾ ਜਿਹਦੇ ਵਿੱਚ ਜ਼ਿਆਦਾਤਰ ਲੋਕਾਂ ਦਾ ਕੰਮ ਕਾਜ ਹੈ ਜੋ ਉਹ ਖੇਤੀਬਾੜੀ ਨਾਲ ਸੰਬੰਧਿਤ ਹੀ ਹੁੰਦਾ ਹੈ ਖੇਤੀਬਾੜੀ ਨਾਲ ਸੰਬੰਧਿਤ ਲੋਕ ਨੇ ਜਿਹੜੇ ਅਕਸਰ ਉਹ ਅਨਪੜ੍ਹ ਹੀ ਹੁੰਦੇ ਨੇ ਪਰ ਮੇਰੀ ਖੁਸ਼ਕਿਸਮਤੀ ਇਹ ਹੈ ਕਿ ਮੈਂ ਖੇਤੀਬਾੜੀ ਵਾਲੇ ਪਰਿਵਾਰ 'ਚੋਂ ਉੱਠਿਆ ਅਤੇ ਉੱਠ ਕੇ ਮੈਂ ਵਿੱਦਿਆ ਦੇ ਨਾਲ ਜੁੜਿਆ ਹੋਇਆ ਹਾਂ ਇਹ ਹੀ ਮੇਰੀ ਇੱਕ ਸਭ ਤੋਂ ਵੱਡੀ ਪ੍ਰਾਪਤੀ ਹੈ ਅਤੇ ਵਿੱਦਿਆ ਪ੍ਰਾਪਤੀ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਸਕੂਲ ਦੇ ਵਿੱਚ ਪੜ੍ਹਾਈ ਕੀਤੀ ਹੈ ਉਸ ਤੋਂ ਬਾਅਦ ਇੰਜੀਨੀਅਰਿੰਗ ਦੀ ਪੜ੍ਹਾਈ ਆਪਣੇ ਪਿੰਡ ਦੇ ਨੇੜਲੇ ਕਾਲਜ ਤੋਂ ਪ੍ਰਾਪਤ ਕੀਤੀ ਹੈ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚੋਂ ਮਾਸਟਰ ਦੀ ਡਿਗਰੀ ਲਈ ਹੈ ਅਤੇ ਮਾਸਟਰ ਦੀ ਡਿਗਰੀ ਦੇ ਵਿੱਚ ਮੈਂ ਆਪਣੇ ਨਾਮ ਦੇ ਉੱਪਰ ਡੈਜ਼ਰਟੇਸ਼ਨ ਲਿਖੀ ਹੈ ਜੋ ਇੱਕ ਖੋਜ ਕਾਰਜ ਹੁੰਦਾ ਹੈ ਤੁਹਾਡਾ ਉਹ ਕੀਤਾ ਹੈ ਉਸ ਤੋਂ ਬਾਅਦ ਜਿਹੜੀ ਮੇਰੀ ਸਭ ਤੋਂ ਵੱਡੀ ਪ੍ਰਾਪਤੀ ਹੈ ਜਿਹਦੇ 'ਤੇ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਉਹ ਇਹ ਹੀ ਹੈ ਕਿ ਜਿਹੜੀ ਮੇਰੀ ਮਨਪਸੰਦੀ ਦੀ ਪੜ੍ਹਾਈ ਸੀ ਉਹ ਸੀ ਧਰਮ ਅਧਿਐਨ ਸਿੱਖ ਅਧਿਐਨ ਉਹਦੇ ਵਿੱਚ ਵੀ ਮੈਂ ਸ਼ਾਮਿਲ ਹੋਇਆ ਹਾਂ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੈਂ ਧਰਮ ਅਧਿਐਨ ਦਾ ਵਿਦਿਆਰਥੀ ਬਣਿਆ ਹਾਂ ਅਤੇ ਇਹਦੇ ਵਿੱਚ ਮੈਂ ਆਪਣੇ ਆਪ ਨੂੰ ਅੱਗੇ ਸਿੱਖ ਵਿਦਵਾਨ ਨੂੰ ਬਣਨ ਵਾਲੇ ਰਾਹ ਦੇ ਉੱਪਰ ਤੋਰ ਰਿਹਾ ਹਾਂ ਇਸੇ ਹੀ ਪ੍ਰਾਪਤੀ ਦੇ ਉੱਤੇ ਮੈਨੂੰ ਮੈਂ ਮਾਣ ਮਹਿਸੂਸ ਹੁੰਦਾ ਹੈ